ਪੰਜਾਬੀ ਸੱਭਿਆਚਾਰ ਵਿੱਚ ਔਰਤਾਂ ਦੀ ਮਹਾਂਵਾਰੀ ਇੱਕ ਅਜਿਹੀ ਚੀਜ਼ ਹੈ ਜੋ ਔਰਤ ਦੀ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਜੇਕਰ ਇਹ ਨਾ ਹੋਵੇ ਤਾਂ ਔਰਤ ਦੀ ਸਿਹਤ ਸਹੀ ਨਹੀਂ ਹੋ ਸਕਦੀ ਉਸਨੂੰ ਬਹੁਤ ਸਾਰੀਆਂ ਪ੍ਰੋਬਲਮਜ਼ ਵੀ ਆ ਸਕਦੀਆਂ ਹਨ ਇਸਦੇ ਲਈ ਮਹਾਂਮਾਰੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮਹਾਂਮਾਰੀ ਵਿੱਚ ਸਹੀ ਸਹੀ ਚੀਜ਼ ਸਹੀ ਸੈਨਾਟਾਈਜ਼ਰ ਯੂਜ਼ ਕਰਨਾ ਚਾਹੀਦਾ ਹੈ ਨਾ ਕਿ ਮਹਾਂਮਾਰੀ ਵਿੱਚ ਕੋਈ ਕੱਪੜਾ ਕੋਈ ਗੰ ਕੋਈ ਬੈਡ ਕੁਝ ਹੋਰ ਚੀਜ਼ ਕੁਝ ਵੀ ਇੱਦਾਂ ਦਾ ਯੂਜ਼ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ਼ ਉਸਨੂੰ ਕੋਈ ਪ੍ਰੋਬਲਮ ਹੋਵੇ ਜੇਕਰ ਵਧੀਆ ਸੈਨਾਟਾਈਜ਼ਰ ਸਹੀ ਢੰਗ ਨਾਲ ਯੂਜ਼ ਕਰਨਾ ਸਿਖਾਇਆ ਜਾਏ ਉਹਨਾਂ ਨੂੰ ਦੱਸਿਆ ਜਾਏ ਕੋਈ ਇਸਦੇ ਲਈ ਕੋਈ ਸੰਗਠਨ ਕੋਈ ਸਮਾਗਮ ਕੁਝ ਇੱਦਾਂ ਦਾ ਹੋਵੇ ਜਿਸ ਦੇ ਵਿੱਚ ਇਸਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਾ ਸਕੇ ਤਾਂ ਜੋ ਇਹਨਾਂ ਨੂੰ ਇਸ ਇਸ ਮਹਾਂਮਾਰੀ ਨਾਲ਼ ਸੰਬੰਧਿਤ ਜੋ ਵੀ ਸਮੱਸਿਆਵਾਂ ਆਉਂਦੀਆਂ ਹਨ ਉਹ ਉਹਨਾਂ ਨੂੰ ਘੱਟ ਕੀਤਾ ਜਾ ਸਕੇ ਇਸਦੇ ਲਈ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਾਗਰੂਕਤਾ ਪੈਦਾ ਕਰਨੀ ਜ਼ਰੂਰੀ ਹੈ ਜਿਸ ਲਈ ਉਹਨਾਂ ਦੀ ਸਿਹਤ ਵਧੀਆ ਹੋ ਸਕੇ ਅਤੇ ਇੱਕ ਸਵੱਛਤਾ ਬਣੀ ਰਹੇ ਇਸਦੇ ਲਈ ਇੱਕ ਜਾਗਰੂਕ ਸਮਾਗਮ ਆਦਿ ਸਾਰਾ ਕੁਝ ਇੱਦਾਂ ਦਾ ਹੋਣਾ ਚਾਹੀਦਾ ਏ ਤਾਂ ਜੋ ਉਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਅਵੇਅਰਨੈਸ ਜ਼ਿਆਦਾ ਜਾਗਰੂਕਤਾ ਪੈਦਾ ਹੋ ਸਕੇ ਅਤੇ ਉਹ ਇੱਦਾਂ ਦੀਆਂ ਬਿਮਾਰੀਆਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਹੋ ਸਕਣ